ਮੈਨੂੰ ਵਕੀਲ ਪੁਲਿਸ ਪੰਚਾਇਤ ਜਾਂ ਤਹਿਸੀਲ ਦਫ਼ਤਰ ਦੇ ਲੋਕਾਂ ਵਰਗੇ ਕਾਨੂੰਨੀ ਅਧਿਕਾਰਾਂ ਲਈ ਬਹੁਤ ਮੁਸ਼ਕਿਲ ਆਈ ਹੈ ਜਦੋਂ ਕਿ ਮੈਂ ਆਪਣਾ ਇੱਕ ਵਾਰ ਆਪਣੇ ਘਰ ਦਾ ਸਰਟੀਫਿਕੇਟ ਬਣਾਉਣ ਗਿਆ ਸੀ ਪੰਚਾਇਤ ਵਿੱਚ ਤਾਂ ਉਹਨਾਂ ਨੇ ਅਦਾਲਤ ਵਿੱਚ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਦੋ ਮੁੰਡੇ ਮਿਲੇ ਦੋ ਅਫ਼ਸਰ ਮਿਲੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਕੰਮ ਜਲਦੀ ਤੋਂ ਜਲਦੀ ਕੰਮ ਕਰ ਦਿੱਤਾ ਜਾਵੇਗਾ ਨਾ ਤੁਹਾਨੂੰ ਲਾਈਨ 'ਚ ਲੱਗਣਾ ਪਵੇਗਾ ਨਾ ਕੁੱਛ ਕਰਨਾ ਪਵੇਗਾ ਤੁਸੀਂ ਬਸ ਇੰਨੇ ਪੈਸੇ ਦਿਓ ਅਤੇ ਮੈਂ ਕਰਦਾਂਗਾ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਸ ਕਾਨੂੰਨੀ ਖਿਲ ਕਾਨੂੰਨ ਦੇ ਖਿਲਾਫ਼ ਹੈ ਇਸ ਲਈ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਆਪਣੇ ਅਸਲੀ ਡਾਕੂਮੈਂਟ ਬਣਾਉਣਾ ਚਾਹੁੰਦਾ ਹਾਂ ਜਿਹੜੇ ਕਿ ਅਸਲੀ ਹੋਣ ਮੈਂ ਇਹ ਗਲਤ ਕੰਮ ਗਲਤ ਕਦਮ ਚੁੱਕ ਕੇ ਇਹ ਸਭ ਕੁਛ ਨਹੀਂ ਚੱਲਣਾ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਇਹ ਰੱਬ ਵੇਖਦਾ ਹੈ ਕਿਉਂਕਿ ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਅਸਲੀ ਉਹ ਬਣਾਓ ਸਰਟੀਫਿਕੇਟ ਬਣਾ ਕੇ ਦਿਓ ਤਾਂ ਜੋ ਮੈਂ ਅੱਗੇ ਪਰੂਫ਼ ਦੇ ਸਕਾਂ ਕਿ ਇਹ ਮੇਰੇ ਘਰ ਦਾ ਹੀ ਸਰਟੀਫਿਕੇਟ ਹੈ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਇਹ ਕੰਮ ਛੱਡ ਦਿਓ ਕਿਉਂਕਿ ਕਾਨੂੰਨੀ ਅਦਾਲਤ ਵਿੱਚ ਇਹ ਸਭ ਰਹਿ ਕੇ ਤੁਸੀਂ ਕਾਨੂੰਨ ਦੇ ਖਿਲਾਫ਼ ਤੁਰੋਂਗੇ ਅਤੇ ਤੁਹਾਡੇ 'ਤੇ ਭਰੋਸਾ ਕੌਣ ਕਰੇਗਾ ਅੱਜ ਤੋਂ ਬਾਅਦ ਕਾਨੂੰਨ 'ਤੇ ਭਰੋਸਾ ਕੌਣ ਕਰੇਗਾ ਇਸ ਲਈ ਮੈਂ ਇਹ ਕਿਹਾ ਕਿ ਮੈਨੂੰ ਬਹੁਤ ਇਸ ਲਈ ਮੈਂ ਜਦੋਂ ਇੱਕ ਵਾਰ ਹੋਰ ਵੀ ਸਰਟੀਫਿਕੇਟ ਬਣਾਉਣ ਗਿਆ ਸੀ ਅਤੇ ਮੈਨੂੰ ਦੁਬਾਰਾ ਇਹ ਹੀ ਮੁਸ਼ਕਿਲ ਆਈ ਸੀ ਪਰ ਫਿਰ ਮੈਂ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਸਮਝਾਇਆ ਕਿ ਇਹ ਸਭ ਨਹੀਂ ਕਰਨਾ ਚਾਹੀਦਾ ਇਸ ਲਈ ਫਿਰ ਉਹ ਮੰਨ ਗਏ ਅਤੇ ਮੈਂ ਅੰਦਰ ਜਾ ਕੇ ਆਪਣੇ ਸਰਟੀਫਕੇਟ ਕਰਵਾਏ ਅਤੇ ਮੈਨੂੰ ਇਸ ਲਈ ਉਹਨਾਂ ਦੇ ਕਾਰਣ ਬਹੁਤ ਮੁਸ਼ਕਿਲ ਆਈਆਂ ਮੈਨੂੰ ਵਾਰ ਵਾਰ ਧੱਕੇ ਖਾਣੇ ਪਏ ਇੱਧਰ ਕਦੇ ਉੱਧਰ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕੰਮ ਕਰੋ ਉੱਧਰ ਚੱਲ ਜਾਓ ਇੱਧਰ ਚੱਲ ਜਾਓ ਇਸ ਇੱਧਰ ਗਿਆ ਉੱਧਰ ਗਿਆ ਪਰ ਮੈਨੂੰ ਵਾਰ ਵਾਰ ਲਾਈਨਾਂ ਵਿੱਚ ਲੱਗਣਾ ਪਿਆ ਇਸ ਲਈ ਮੈਂ ਤੁਹਾਨੂੰ ਮੈਨੂੰ ਇਸ ਲਈ ਅਦਾਲਤ ਪੁਲਿਸ ਅਫ ਪੁਲਿਸ ਪੰਚਾਇਤ ਜਾਂ ਤਹਿਸੀਲ ਦਫ਼ਤਰ ਦੇ ਲੋਕਾਂ ਵਰਗੇ ਕਾਨੂੰਨੀ ਅਧਿਕਾਰਾਂ ਲਈ ਬਹੁਤ ਮੁਸ਼ਕਿਲ ਆਈ ਹੈ